ਹਾਂ ਮੈਂ ਸਕੂਲ ਟਾਈਮ ਬਹੁਤ ਜ਼ਿਆਦਾ ਗਰੀਟਿੰਗ ਬਣਾਉਂਦੀ ਰਹੀ ਹਾਂ ਅਤੇ ਹੁਣ ਵੀ ਬਣਾਉਂਦੀ ਹਾਂ ਅਤੇ ਮੈਂ ਆਪਣੇ ਟੀਚਰ ਨੂੰ ਕਈ ਵਾਰੀ ਗਰੀਟਿੰਗ ਦਿੱਤੇ ਹੈ ਜਿਵੇਂ ਟੀਚਰਸ ਡੇ 'ਤੇ ਦਿੱਤੇ ਹੈ ਅਤੇ ਸਕੂਲ ਜਿਵੇਂ ਕੋਈ ਫੰਕਸ਼ਨ ਹੁੰਦੇ ਸੀ ਉਦੋਂ ਵੀ ਅਸੀਂ ਹੋਲੀ ਦਿਵਾਲੀ 'ਤੇ ਵੀ ਗਰੀਟਿੰਗ ਬਣਾ ਕੇ ਅਸੀਂ ਦਿੱਤੇ ਹੈ ਅਤੇ ਆਪਣੇ ਟੀਚਰ ਨੂੰ ਅਤੇ ਭਗਵਾਨ ਗਣੇਸ਼ ਦਾ ਜਾ ਜਨਮ ਦਿਨ ਹੁੰਦਾ ਗਣੇਸ਼ ਚਤੁਰਥੀ 'ਤੇ ਉਦੋਂ ਮੈਂ ਗਣੇਸ਼ ਭਗਵਾਨ ਦੀ ਮੂਰਤੀ ਵੀ ਬਣਾਈ ਸੀ ਅਤੇ ਪੱਤਰ ਵੀ ਮੇਰੇ ਕੋਲ ਹੈਗੇ ਆ ਹਜੇ ਤੱਕ ਬਣਾਏ ਹੋਏ ਅਤੇ ਉਹ ਮਤਲਬ ਮੈਂ ਸਾਂਭ ਕੇ ਰੱਖੇ ਹੋਏ ਹੈ ਕਿਉਂਕਿ ਉਹ ਮੇਰੇ ਬਣਾਏ ਹੋਏ ਨੇ ਅਤੇ ਮੈਨੂੰ ਜਦੋਂ ਮੈਂ ਵੇਖਦੀ ਹਾਂ ਉਦੋਂ ਮਤਲਬ ਸਕੂਲ ਟਾਈਮ ਵੀ ਚੇਤੇ ਆ ਜਾਂਦਾ ਅਤੇ ਵੇਖ ਕੇ ਵੀ ਬਹੁਤ ਖੁਸ਼ੀ ਹੁੰਦੀ ਵੀ ਉਦੋਂ ਅਸੀਂ ਆਹ ਗਰੀਟਿੰਗ ਵੀ ਤਿਆਰ ਕਰਦੇ ਸੀ ਅਤੇ ਟੀਚਰ ਨੂੰ ਦਿੰਦੇ ਸੀ ਅੱਜ ਵੀ ਉਹ ਮੇਰੇ ਕੋਲ ਕੁਝ ਗ੍ਰੀਟਿੰਗ ਹਜੇ ਵੀ ਪਏ ਨੇ ਹੁਣ ਮੈਂ ਕਾਲਜ ਟਾਈਮ ਵੀ ਉਹ ਕਿਸੇ ਟੀਚਰ ਨੂੰ ਜ਼ਰੂਰ ਦੇਵਾਂਗੀ ਅਤੇ ਮੈਨੂੰ ਹੱਥ ਨਾਲ ਬਣਾਈ ਹੋਈ ਚੀਜ਼ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੀ ਹੈ ਕਿਉਂਕਿ ਉਹਦੇ ਵਿੱਚ ਮੇਰੀ ਆਰਟ ਮੇਰੀ ਕਲਾ ਉਹ ਝਲਕਦੀ ਹੈ ਵੀ ਹਾਂ ਮੈਂ ਕਿੰਨਾ ਪਸੰਦ ਕਰਦੀ ਹਾਂ ਆਰਟ ਨੂੰ ਅਤੇ ਪਸੰਦ ਮੈਂ ਇਸ ਲਈ ਕਰਦੀ ਹਾਂ ਕਿਉਂਕਿ ਉਦੋਂ ਮੈਂ ਜਦੋਂ ਬਣਾਉਂਦੀ ਹਾਂ ਉਦੋਂ ਮੈਨੂੰ ਇੰਨੀ ਖੁਸ਼ੀ ਹੁੰਦੀ ਵੀ ਆਹ ਮੈਂ ਟੀਚਰ ਨੂੰ ਦੇਵਾਂਗੀ ਆਹ ਮੇਰੇ ਹਾਂ ਫੇਮਲੀ ਵਿੱਚ ਵੀ ਮੈਂ ਕਈਆਂ ਨੂੰ ਦਿੱਤੇ ਹੈ ਜਾਂ ਮੈਂ ਮੇਰੇ ਭਰਾ ਨੂੰ ਦੇਵਾਂਗੀ ਜਾਂ ਮੇਰੇ ਭੈਣ ਨੂੰ ਦੇਵਾਂਗੀ ਅਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਮੈਂ ਗ੍ਰੀਟਿੰਗ ਆਪਣੇ ਹੱਥ ਨਾਲ ਬਣਾਉਂਦੀ ਹਾਂ ਅਤੇ ਆਪਣੇ ਹੱਥ ਨਾਲ ਉਹਨਾਂ ਨੂੰ ਦਿੰਦੀ ਹਾਂ